ਮੈਂ ਇੱਕ ਸਪੋਰਟਸ ਵੁਮੈਨ ਹਾਂ ਮੇਰੀ ਗੇਮ ਦਾ ਨਾਮ ਕਰਾਟੇ ਹੈ ਇਸ ਗੇਮ ਵਿੱਚ ਮੈਂ ਬਹੁਤ ਸਾਰੇ ਮੈਡਲ ਅਤੇ ਟਰੋਫੀਆਂ ਹਾਸਿਲ ਕੀਤੀਆਂ ਹਨ ਜਿਨ੍ਹਾਂ ਦਾ ਨਾਮ ਮਾਰਸ਼ਲ ਆਰਟ ਪੈਸ਼ਨ ਟਾਈਗਰ ਹੈ ਇੰਨ੍ਹਾਂ ਮੈਡਲਾਂ ਨੂੰ ਹਾਸਲ ਕਰਨ ਦੇ ਲਈ ਬਹੁਤ ਸਾਰੇ ਟੂਰਨਾਮੈਂਟ ਖੇਡੇ ਹਨ ਜਿਹਨਾਂ ਨੂੰ ਖੇਡਣ ਲਈ ਮੈਨੂੰ ਅਲੱਗ ਅਲੱਗ ਸ਼ਹਿਰਾਂ ਵਿੱਚ ਜਾ ਕੇ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਪਿਆ ਅਤੇ ਇਹਨਾਂ ਮੈਡਲਾਂ ਨੂੰ ਹਾਸਲ ਕੀਤਾ ਮੈਂ ਅੱਜ ਆਪਣੇ ਇਹਨਾਂ ਮੈਡਲਾਂ ਨੂੰ ਹਾਸਲ ਕਰਕੇ ਬਹੁਤ ਖੁਸ਼ ਹਾਂ ਨਾਲ ਹੀ ਨਾਲ ਇਹਨਾਂ ਟੂਰਨਾਮੈਂਟ ਦੀ ਵਜਹਾ ਤੋਂ ਮੈਨੂੰ ਬਲੈਕ ਬੈਲਟ ਦੀ ਪ੍ਰਾਪਤੀ ਹੋਈ ਹੈ ਧੰਨਵਾਦ